ਹੈਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਮੈਂ ਤੁਹਾਨੂੰ ਪੁੱਛਣਾ ਸੀ ਕਿ ਸਰ ਮੈਂ ਪੀ ਟੀ ਸੀ ਨਿਊਜ਼ ਤੋਂ ਬੋਲ ਰਿਹਾ ਹਾਂ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਅੰਮ੍ਰਿਤਸਰ ਸਿਟੀ ਵਿੱਚ ਕਿਹੜੇ ਕਿਹੜੇ ਫੇਮਸ ਤਿਉਹਾਰ ਹਨ ਜਿਹੜੇ ਮਨਾਏ ਜਾਂਦੇ ਹਨ ਹਾਂਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਠੀਕ ਭਾਅ ਜੀ ਓਕੇ ਭਾਅ ਜੀ ਧੰਨਵਾਦ